ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਕੀ ਹਾਲ ਹੈ ਬਸ ਠੀਕ ਹੈ ਹਾਂਜੀ ਮੈਂ ਕਿਹਾ ਮੈਂ ਵੰਨਿਕਾ ਦੀ ਮਾਂ ਬੋਲਦੀ ਪਈ ਹਾਂ ਅਤੇ ਉਹ ਨਾ ਉਹ ਸਵੇਰੇ ਨਾ ਉੱਠੀ ਅਤੇ ਉਹਨੂੰ ਉੱਲਟੀਆਂ ਆਲਟੀਆਂ ਆਣ ਲੱਗ ਪਈਆਂ ਅਤੇ ਫਿਰ ਉਹਨੂੰ ਡਾਕਟਰ ਨੂੰ ਜਾ ਕੇ ਚੈੱਕ ਕਰਵਾਇਆ ਅਤੇ ਡਾਕਟਰ ਕਹਿੰਦਾ ਵੀ ਇਹਨੂੰ ਇਹ ਟੈਸਟ ਕਹਿੰਦਾ ਟੈਸਟ ਲੈ ਲਏ ਉਹਨੇ ਕਹਿੰਦਾ ਰਿਪੋਰਟ ਤਾਂ ਹੁਣ ਦੋ ਤਿੰਨ ਦਿਨ ਬਾਅਦ ਆਉਣੀ ਹੈ ਅਤੇ ਕਹਿੰਦਾ ਫਿਰ ਜਦ ਤਾਈ ਅਰਾਮ ਕਰੇ ਘਰ ਅਤੇ ਤਾਂ ਕਰਕੇ ਤਾਂ ਕਰਕੇ ਮੈਂ ਛੁੱਟੀ ਦਾ ਕਹਿੰਦੀ ਪਈ ਸੀ ਛੁੱਟੀ ਮੈਂ ਕਿਹਾ ਦੇ ਦਿਓ ਫਿਰ

ਦੋ ਤਿੰਨ ਦਿਨ ਬਾਅਦ ਰਿਪੋਰਟ ਆਉਣੀ ਹੈ ਅਤੇ ਫਿਰ ਦੋ ਤਿੰਨ ਦਿਨਾਂ ਬਾਅਦ ਭੇਜ ਦਵਾਂਗੀ ਪੜ੍ਹਾਈ ਇਹਦੀ ਕਿੱਦਾਂ ਮੈਥ ਵੀਕ ਹੈ ਅੱਛਾ ਟਿਊਸ਼ਨ ਰੱਖ ਦਿੰਦੇ ਜੀ ਫਿਰ ਓ ਉਹੀ ਕਹਿੰਦੀ ਆ ਬਸ ਇੱਦਾਂ ਹੀ ਬੱਚੇ ਹੁੰਦੇ ਆ ਹਾਂ ਹਾਂ ਹਾਂ ਠੀਕ ਹੈ ਠੀਕ ਹੈ ਹਾਂਜੀ ਇਹ ਤਾਂ ਗੱਲ ਹੈਗੀ ਹੈ ਹਾਂ ਚਲੋ ਠੀਕ ਹੈ ਚਲੋ ਠੀਕ ਹੈ ਫਿਰ ਓਕੇ ਓਕੇ ਜੀ ਓਕੇ